ਹੈਲੋ ਉਬਰ ਕੈਬ ਤੋਂ ਬੋਲਦੇ ਜੀ ਹਾਂਜੀ ਡਰਾਈਵਰ ਰਣਜੀਤ ਸਿੰਘ ਨਾਲ਼ ਗੱਲ ਹੋ ਰਹੀ ਆਪਾਂ ਕੈਬ ਕੈਬ ਤੁਹਾਡੀ ਬੁੱਕ ਕੀਤੀ ਸੀ ਕਿ ਠਾਠਗੜ੍ਹ ਤੋਂ ਆਪਾਂ ਸ਼ਿਮਲੇ ਜਾਣਾ ਘੁੰਮਣ ਲਈ ਆਪਣਾ ਪਿੰਡ ਠਾਠਗੜ੍ਹ ਆ ਅਤੇ ਅਠਾਰ੍ਹਾਂ ਮਾਰਚ ਨੂੰ ਆਪਾਂ ਚੱਲਣਾ ਵਾ ਦਸ ਕੁ ਮੈਂਬਰ ਨੇ ਆਪਣੇ ਫਰੈਂਡਸ ਨੇ ਨਾਲ਼ ਰਿਲੇਟਿਵਸ ਨੇ ਨੌ ਕੁ ਵਜੇ ਆਪਾਂ ਤੁਰਨਾ ਇੱਥੋਂ ਸਾਰਿਆਂ ਨੂੰ ਦੱਸਿਆ ਵੀ ਇਨਫੋਰਮ ਕੀਤਾ ਵਾ ਕਿ ਆਪਾਂ ਨੌ ਕੁ ਵਜੇ ਇੱਥੋਂ ਤੁਰ ਪੈਣਾ ਅਤੇ ਸਾਰਿਆਂ ਨੇ ਤਕਰੀਬਨ ਨੌ ਕੁ ਵਜੇ ਦੇ ਟਾਈਮ ਨਾਲ਼ ਪਹੁੰਚ ਜਾਣਾ ਆਪਣੇ ਕੋਲ ਆਪਣੇ ਪਿੰਡ ਇੱਥੇ ਠਾਠਗੜ੍ਹ ਹੀ ਅਤੇ ਤੁਸੀਂ ਮੈਨੂੰ ਦੱਸੋ ਮਾੜਾ ਜਾ ਕਿ ਤੁਸੀਂ ਟਾਈਮ ਨਾਲ਼ ਪਹੁੰਚਜੋਗੇ ਨੌ ਵਜੇ ਪਹੁੰਚ ਜਾਇਓ ਹੈਂ ਤਾਂ ਜੋ ਆਪਾਂ ਸਾਰਿਆਂ ਨੂੰ ਕੋਈ ਤੁਹਾਡੀ ਜ਼ਿਆਦੇ ਵੇਟ ਨਾ ਕਰਨੀ ਪਵੇ ਅਤੇ ਤੁਸੀਂ ਮੈਨੂੰ ਦਸ ਕੁ ਫੋਨ ਕਰਕੇ ਦੱਸ ਦਿਓ ਕਿ ਤੁਸੀਂ ਨੈੱਟ ਨੌ ਵਜੇ ਪਿੰਡ ਠਾਠਗੜ੍ਹ ਪਹੁੰਚ ਜਾਉਗੇ